ਇਹ ਸੱਚ ਹੈ ਕਿ ਸਾਡੇ ਪੰਜਾਬ ਵਿਚ ਬਹੁਤ ਸਾਰੀਆਂ ਕਲਾ ਹਨ ਸਾਡੇ ਪੰਜਾਬ ਵਿੱਚ ਬਹੁਤ ਸਾਰੀਆਂ ਕਲਾ ਹਨ ਅਸੀਂ ਇੱਕ ਆਪਦੀਆਂ ਕਲਾ ਹੋਰ ਦੇਸ਼ਾਂ ਵਿੱਚ ਵੀ ਦਿਖਾ ਸਕਦੇ ਹਾਂ ਜਿਵੇਂ ਕਿ ਆਹਾ ਨਾਵਲ ਨਾਟਕ ਪ੍ਰਿੰਟਿੰਗ ਪ੍ਰਿੰਟਿੰਗ ਕੁਛ ਹੋ ਹੋਰ ਵੀ ਬਹੁਤ ਸਾਰੀਆਂ ਕਲਾ ਅਸੀਂ ਸਿਨਮਾ ਹਾਲ ਵਿੱਚ ਕੋਈ ਟੀਵੀ ਟੈਲੀ ਰੇਡੀਓ ਟੈਲੀਵਿਜ਼ਨ ਵਿੱਚ ਦਿਖਾ ਸਕਦੇ ਹਾਂ ਅਸੀਂ ਆਪਦੀਆਂ ਕਲਾ ਦੂਜਿਆਂ ਨੂੰ ਵੀ ਦਿਖਾ ਸਕਦੇ ਹਾਂ ਅਤੇ ਭਾਵ ਕਰ ਸਕਦੇ ਹਾਂ ਅਸੀਂ ਨਾ ਜੱਦ ਕਿ ਅਸੀਂ ਨਾਟਕ ਖੇਡਦੇ ਹਾਂ ਤਾਂ ਉਹਨਾਂ ਨੂੰ ਇੱਕ ਇੱਕ ਵਧੀਆ ਤਰੀਕੇ ਨਾਲ ਦਿਖਾ ਸਕਦੇ ਹਾਂ ਅਤੇ ਸਾਡੀ ਕਲਾ ਇੱਕ ਦੂਜੇ ਵਿੱਚ ਇਹ ਇੱਕ ਅਸੀਂ ਆਪਦੀ ਕਲਾ ਹੋਰ ਲੋਕਾਂ ਨੂੰ ਵੀ ਦੇ ਸਕਦੇ ਹਾਂ ਕਿਉਂਕਿ ਭਾਰਤ ਵਿੱਚ ਕ ਰਾ ਭਾਰਤ ਵਿੱਚ ਕਲਾ ਬਹੁਤ ਹੀ ਮਸ਼ਹੂਰ ਹੈ ਕਿਉਂਕਿ ਵੱਡੇ ਵੱਡੇ ਉਹ ਵੱਡੇ ਵੱਡੇ ਨਾਵਲ ਵੀ ਹਾਂ ਜਿਹਨਾਂ ਨੇ ਨਾਵਲ ਲਿਖਿਆ ਕੋਈ ਵੀ ਕਲਾ ਲਿਖੀ ਅਤੇ ਅਸੀਂ ਇੱਕ ਦੂਜੇ ਨੂੰ ਕਲਾ ਹਾਂ ਸਮਝਾ ਦਿਖਾ ਸਕਦੇ ਹਾਂ ਆਪਦੀ ਕਲਾ ਵੀ ਸਾਡੇ 'ਚ ਕਿੰਨੀ ਕੁ ਕਲਾ ਹੈ ਅਸੀਂ ਕੀ ਕਰ ਸਕਦੇ ਹਾਂ ਕੀ ਨਹੀਂ ਕਰ ਸਕਦੇ ਕਿਉਂਕਿ ਅਸੀਂ ਕਲਾ ਕਲਾ ਦੇ ਵਿੱਚ ਹਾਂ ਅਸੀਂ ਦੂਸਰੇ ਦੇਸ਼ਾਂ ਵਿੱਚ ਜਾ ਕੇ ਹਾਂ ਜਦੋਂ ਆਪਦੀ ਕਲਾ ਦਿਖਾਉਂਦੇ ਹਾਂ ਤਾਂ ਉਹ ਸਾਨੂੰ ਬਹੁਤ ਹੀ ਵਧੀਆ ਮਹਿਸੂਸ ਕਰਦੇ ਹਨ ਵੀ ਇਹਨਾਂ ਵਿੱਚ ਕਿੰਨੀ ਕਲਾ ਵੀ ਸਾਡੇ 'ਚ ਵੀ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਦੂਜਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਾਂ ਵੀ ਅਸੀਂ ਸਭ ਕੁਛ ਕਰ ਸਕਦੇ ਹਾਂ ਅਸੀਂ ਵੀ ਅਸੀਂ ਐਂ ਨਹੀਂ ਵੀ ਅਸੀਂ ਕਰ ਨਹੀਂ ਸਕਦੇ ਆਪਦੀ ਕਲਾ ਦਿਖਾਉਣੀ ਹੁੰਦੀ ਆ ਵੀ ਸਾਡੇ 'ਚ ਕੀ ਉਹ ਆ ਟੇਲੇਂਟ ਆ ਵੀ ਅਸੀਂ ਕਿੰਨੀ ਕੁ ਕਲਾ ਇੱਕ ਦੂਜੇ ਨੂੰ ਦੇ ਸਕਦੇ ਹਾਂ ਕਿਉਂਕਿ ਵੱਡੇ ਵੱਡੇ ਉਚ ਉਚ ਸਿਨਮਾ 'ਚ ਵੀ ਸਾਡੀ ਕਲਾ ਦਿਖਾ ਸਕਦੇ ਹੋ ਕਿਉਂਕਿ ਸਾਡੇ ਆਪਦਾ ਹੀ ਸਾਡਾ ਨਾਮ ਰੋਸ਼ਨ ਹੁੰਦਾ ਹੈ